ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਠੀਕ ਹੈ ਵਧੀਆ ਤੁਸੀਂ ਦੱਸੋ ਬਸ ਬੈਠੇ ਸੀਗੇ ਇੱਕ ਮੈਂ ਕੱਲ੍ਹ ਬਾਜ਼ਾਰ ਗਈ ਸੀਗੀ ਅਤੇ ਉਹਦੇ ਬਾਰੇ ਸੋਚ ਰਹੀ ਸੀਗੀ ਅਸੀਂ ਕੱਲ੍ਹ ਬਾਜ਼ਾਰ ਗਏ ਅਤੇ ਟ੍ਰੈਫਿਕ ਇੰਨਾ ਸੀਗਾ ਮਸਾਂ ਲੰਘ ਕੇ ਆਏ ਅੱਛਾ ਹਾਂਜੀ ਗ ਗਾਂਧੀ ਚੌਂਕ ਸੀ ਗਾਂਧੀ ਚੌਂਕ ਅਸੀਂ ਪਰਲੀ ਸਾਈਡ ਸੀਗੀ ਤੁਸੀਂ ਉਰਲੀ ਸਾਈਡ ਹੋਓਂਗੇ ਨਾ

ਹਾਂਜੀ ਹਾਂਜੀ

ਹਾਂਜੀ ਹਾਂਜੀ ਟ੍ਰੈੇਫਕ ਜ਼ਿਆਦਾ ਹੋਣ ਕਰਕੇ ਵੀ ਉੱਥੇ ਤਾਂ ਲੰਘਣ ਨੂੰ ਥਾਂ ਨਹੀਂ ਹੁੰਦਾ ਤਾਂ ਇੰਨਾ ਉੱਥੇ ਉੱਥੇ ਭੀੜ ਹੁੰਦੀ ਇੱਕ ਤਾਂ ਇੱਥੇ ਦਾ ਇੱਥੇ ਜਿਹੜਾ ਰੋਡ ਹੈਗਾ ਉਹ ਇੰਨਾ ਟਾਈਟ ਹੈਗਾ ਇੱਕ ਜਿਹੜੇ ਲੋਕ ਹੈਗੇ ਆ ਉਹ ਵੀਹਕਲ ਵੀ ਵੱਡੇ ਵੱਡੇ ਕਾਰਾਂ ਲੈ ਕੇ ਜਾਂਦੇ ਆ ਵੀ ਮਤਲਬ ਜੇ ਉਸ ਗਲੀ 'ਚ ਜਾਣਾ ਜੇ ਤੁਸੀਂ ਟਾਈਟ ਗਲੀ 'ਚ ਜਾਣਾ ਤੁਸੀਂ ਕਾਰ ਕਿਉਂ ਲੈ ਕੇ ਜਾਂਦੇ ਹੋ ਵੀ ਬਾਈਕ ਲੈ ਜਾਉ ਜੇ ਬਾਈਕ ਬਾਈਕ ਨਾਲ ਵੀ ਉੱਥੇ ਤਾਂ ਬਹੁਤ ਹੁੰਦਾ ਹੂੰ ਹੂੰ ਫੇਰ ਤੁਸੀਂ ਹੂੰ ਪ੍ਰੋਬਲਮ ਜੇ ਤੁਸੀਂ ਮੇਰੇ ਨਾਲ ਜਾਣਾ ਹੀ ਹੈ ਤੁਸੀਂ ਸ਼ੋਪਿੰਗ ਕਰਨ ਜਾਣਾ ਤੁਸੀਂ ਪੈਦਲ ਜਾਓ ਸ਼ੋਪਿੰਗ ਕਰਨ ਐਵੇਂ ਸੌਖਾ ਜਦੋਂ ਵੀਹਕਲ ਨਾਲ ਲੈ ਕੇ ਜਾਓਗੇ ਤਾਂ ਤੁਸੀਂ ਵੀ ਮਤਲਬ ਕਿੰਨਾ ਔਖਾ ਹੁੰਦਾ ਉਹਨੂੰ ਉਹਨੂੰ ਕਿੱਥੇ ਖੜ੍ਹਾਵਾਂਗੇ ਐਂ ਪ੍ਰੋਬਲਮ ਹੁੰਦੀ ਹੈ ਹੂੰ ਹੂੰ ਹੂੰ ਹੂੰ ਹੂੰ ਹੂੰ ਇਹਦਾ ਸਲਿਊਸ਼ਨ ਵੀ ਹੋਣਾ ਚਾਹੀਦਾ ਇਹਦਾ ਸਲਿਊਸ਼ਨ ਆਹੀ ਆ ਵੀ ਆਪਾਂ ਆਪਾਂ ਤਾਂ ਆਪਣੇ ਆਪ ਨੂੰ ਸੁਧਾਰ ਲੈਂਦੇ ਵੀ ਆਪਾਂ ਐਂ ਜਾਈਏ ਜਾਂ ਐਂ ਟ੍ਰੈਫਿਕ ਹੋ ਜਾਂਦਾ ਪਰ ਸਾਰੇ ਲੋਕਾਂ ਨੂੰ ਵੀ ਇਹੀ ਸੋਚਣਾ ਚਾਹੀਦਾ ਨਾ ਵੀ ਹਾਂ ਵੀ ਐਂ ਜਿਵੇਂ ਛੋਟਾ ਜਿਵੇਂ ਪੈਦਲ ਜਾਵਾਂਗੇ ਜਾਂ ਛੋਟਾ ਵੀਹਕਲ ਲੈ ਕੇ ਜਾਵਾਂਗੇ ਤਾਂ ਫੇਰ ਵੀ ਅਸੀਂ ਸੌਖੇ ਲੰਘ ਸਕਦੇ ਹਾਂ ਨਹੀਂ ਤਾਂ ਫਿਰ ਟ੍ਰੈਫਿਕ ਜਾਮ ਹੀ ਹੋਊਗਾ ਅਸੀਂ ਉੱਥੇ ਨਾ ਕੱਲ੍ਹ ਤਿੰਨ ਚਾਰ ਘੰਟੇ ਲੱਗ ਗਏ ਉੱਥੇ ਟ੍ਰੈਫਕ ਇੰਨਾ ਹੋਇਆ ਪਿਆ ਸੀਗਾ ਅਤੇ ਇੰਨੇ ਘੰਟੇ ਲੱਗਦਾ ਇੰਨਾ ਟੈਮ ਵੇਸਟ ਹੋਇਆ ਘਰ ਆ ਕੇ ਕੋ ਕ ਕੰਮ ਵੀ ਕਰਨੇ ਹੁੰਦੇ ਆ ਉਹ ਪ੍ਰੈਸ ਪ੍ਰੈਸ ਵੀ ਕਰਨੇ ਨੂੰ ਲੇਟ ਹੋ ਗਏ ਉਹ ਆ ਕੇ ਦਿੱਕਤ ਹੋ ਗਈ ਘਰ ਆ ਕੇ ਤਾਂ ਹੂੰ ਔਖਾ ਹੂੰ ਇਹ ਇਹ ਸਮਝਦੇ ਨਹੀਂ ਨਾ ਸਾਰੇ ਨਹੀਂ ਨਾ ਸਮਝਦੇ ਬਸ ਐਂਈਂ ਸਮਝਦੇ ਬਸ ਸਾਡੇ ਕੋਲ ਗੱਡੀਆਂ ਹੈਗੀਆਂ ਅਸੀਂ ਗੱਡੀਆਂ ਹੀ ਲੈ ਕੇ ਜਾਊਂਗੇ ਬਸ ਹੋਰ ਸਾਡੇ ਕੋਲ ਐਂ ਸਮਝਦੇ ਨਾ ਹਵਾ ਹੂੰ ਹੂੰ ਹੂੰ ਹੂੰ ਹੂੰ ਹੋਣੀ ਚਾਹੀਦੀ ਉੱਥੇ ਕੋਈ ਪਾਰਕੀ ਨਹੀਂ ਹੈਗੀ ਉੱਥੇ ਜਾਂਦੇ ਸਾਰੇ ਖੜ੍ਹਾਈ ਜਾਂਦੇ ਹੂੰ ਹਾਂਜੀ ਚਲੋ ਹਾਂਜੀ ਚਲੋ ਕੋਈ ਗੱਲ ਨਹੀਂ ਇਹ ਤਾਂ ਲੋਕਾਂ ਦੀ ਸੋਚ ਆਪਣੀ ਆਪਣੀ ਆਪਣੀ ਬਦਲ ਲਉ ਠੀਕ ਹੈ